ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਦੱਸੋ ਜੀ ਕਾਹਦਾ ਹਾਂਜੀ ਹਾਂਜੀ ਓਕੇ ਠੀਕ ਠੀਕ ਹੈ ਜੀ ਠੀਕ ਹੈ ਜੀ ਹਾਂ ਉਹ ਤਾਂ ਇਹਦੇ ਵਿੱਚੇ ਹੀ ਆ ਜਾਣੀ ਕੋਈ ਗੱਲ ਨਹੀਂ ਜੀ ਹਾਂਜੀ ਹਾਂਜੀ ਹੈਗਾ ਆਪਣੇ ਕੋਲ ਨਹੀਂ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਤੁਸੀਂ ਦੱਸੋ ਵੀ ਇਹ ਕਦੋਂ ਔਡਰ ਚਾਹੀਦਾ ਹੈਗਾ ਤੁਸੀਂ ਇਹ ਵਾਲਾ ਔਡਰ ਕਨਫਰਮ ਕਰਵਾਓ ਆਪਾਂ ਤੁਹਾਨੂੰ ਦੂਜੇ ਦਿਨ ਦੇ ਦੇਵਾਂਗੇ ਪੇਮੈਂਟ ਤਾਂ ਦੇਖੋ ਜੀ ਇਹ ਤਾਂ ਕੁਛ ਦਾ ਕੁਆਲਿਟੀ ਹਿਸਾਬ ਨਾਲ ਵੀ ਦੇਖਿਆ ਜਾਊਗਾ ਨਾ ਵੀ ਜਿਵੇਂ ਤੁਸੀਂ ਬੈਗ ਦੀ ਕੁਆਲਟੀ ਕਿੱਦਾਂ ਦੀ ਲੈਂਦੇ ਹੈਗੇ ਅਤੇ ਬਾਕੀ ਹੁਣ ਇੱਕ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਇੱਦਾਂ ਕਰੋ ਵੀ ਜਿੰਨਾ ਬਿੱਲ ਹੋਇਆ ਉਹ ਬਣਾ ਲਵਾਂਗੇ ਇੱਕ ਵਾਰੀ ਤੁਸੀਂ ਪੰਜਾਹ ਸਟੂਡੈਂਟ ਹੋ ਮਨ ਲਓ ਹਿਸਾਬ ਤੁਸੀਂ ਵੀ ਜੇ ਆਪਾਂ ਆਈਡੀਆ ਮੰਨੀਏ ਵੀ ਇੱਕ ਸਟੂਡੈਂਟ ਦੇ ਉੱਪਰ ਆ ਸੱਤਰ ਰੁਪਏ ਪੈਣੇ ਜੁਮੈਟਰੀ ਮੰਨ ਲਓ ਸਾਰਾ ਸਮਾਨ ਵਿੱਚ ਅਤੇ ਦੋ ਸੌ ਤੀਹ ਕੁ ਰੁਪਏ ਦਾ ਬੈਗ ਮੰਨ ਲਓ ਇੱਧਰ ਢਾਈ ਸੌ ਰੁਪਏ ਦਾ ਉਹੀ ਤ ਤਿੰਨ ਸੌ ਅਤੇ ਸਾਢੇ ਤਿੰਨ ਸੌ ਰੁਪਈਆ ਆਜੁ ਇੱਕ ਜਵਾਕ ਦਾ ਜੀ ਹਾਂਜੀ ਦੇਖ ਲਓ ਜੀ ਆਪਣਾ ਸਾਢੇ ਕੁ ਸਤਾਈ ਸੌ ਬਣਦਾ ਤੁਸੀਂ ਤੁਹਾਨੂੰ ਦਸ ਪਰਸੈਂਟ ਡਿਸਕਾਊਂਟ ਕਰ ਦਿਆਂਗੇ ਹਾਂ ਤੁਸੀਂ ਦੱਸਦਾ ਹਾਂ ਤੁਸੀਂ ਦੇਖ ਲਓ ਬਸ ਜੀ ਇਹ ਵੀ ਪੱਚੀ ਸੌ ਰੁਪਏ ਦੇ ਦਿਓ ਚਲੋ ਕੋਈ ਗੱਲ ਨਹੀਂ ਜੀ ਆ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਦੁਕਾਨ 'ਤੇ ਆ ਜਾਇਓ ਜੀ ਅਤੇ ਦੁਕਾਨ 'ਤੇ ਆ ਕੇ ਆਪਾਂ ਕਰ ਲਵਾਂਗੇ ਗੱਲ ਕੋਈ ਨਾ ਬਹਿ ਕੇ ਠੀਕ ਹੈ ਜੀ ਓਕੇ